ਪੰਜਾਬ ਵਿੱਚ ਬਹੁਤ ਸਾਰੇ ਵੱਡੇ ਉਦਯੋਗ ਹਨ ਜਿਸ ਵਿੱਚ ਸਭ ਤੋਂ ਪ੍ਰਮੁੱਖ ਲੁਧਿਆਣਾ ਦਾ ਵੂਲਨ ਇੰਡਸਟਰੀ ਆਉਂਦੀ ਹੈ ਵੂਲਨ ਇੰਡਸਟਰੀ ਬਹੁਤ ਹੀ ਵੱਡੇ ਸਕੇਲ 'ਤੇ ਫੈਲੀ ਹੋਈ ਹੈ ਇਸ ਦੇ ਨਾਲ ਇਸ ਦ ਇਸ ਤੋਂ ਸਾਰੇ ਪੰਜਾਬ ਸਾਰਾ ਇੰਡੀਆ ਦੇ ਵਿੱਚ ਮਾਲ ਸਪਲਾਈ ਕੀਤਾ ਜਾਂਦਾ ਹੈ ਈਵਨ ਕਿ ਦੂਰ ਦਰਾਜ ਵੱਡ ਵਿਦੇਸ਼ਾਂ ਵਿੱਚ ਵੀ ਮਾਲ ਭੇਜਿਆ ਜਾਂਦਾ ਹੈ ਦੂਸਰੀ ਪ੍ਰਮੁੱਖ ਇੰਡਸਟਰੀ ਜਿਹੜੀ ਹੈਗੀ ਹੈ ਮੰਡੀ ਗੋਬਿੰਦਗੜ੍ਹ ਦੀ ਹੈ ਜਿਸ ਦੇ ਵਿੱਚ ਲੋਹਾ ਬਹੁਤ ਵੱਡੀ ਮਾਤਰਾ ਦੇ ਵਿੱਚ ਭੇਜਿਆ ਅਤੇ ਤਿਆਰ ਕੀਤਾ ਜਾਂਦਾ ਹੈ ਤੀਸਰਾ ਇੱਥੇ ਖੇਤੀਬਾੜੀ ਦਾ ਵੀ ਬਹੁਤ ਹੀ ਵੱਡਾ ਉਦਯੋਗ ਹੈ ਇਸ ਤੋਂ ਬਹੁਤ ਸਾਰੇ ਪਰਿਵਾਰਾਂ ਦਾ ਪੇਟ ਭਰ ਕੇ ਆਪਣਾ ਗੁਜ਼ਾਰਾ ਕਰਦੇ ਹਨ ਤੀਸਰਾ ਚੌਥਾ ਇੱਥੇ ਜਿਹੜਾ ਹੈ ਕਪੂਰਥਲੇ ਦੇ ਵਿੱਚ ਫਰਨੀਚਰ ਇੰਡਸਟਰੀ ਵੀ ਬਹੁਤ ਹੀ ਵੱਡੇ ਪੱਧਰ 'ਤੇ ਹੈ ਉੱਥੋਂ ਦਾ ਫਰਨੀਚਰ ਬੜਾ ਹੀ ਮਸ਼ਹੂਰ ਹੈ ਲੋਕੀ ਬੜੇ ਦੂਰ ਦਰਾਜੇ ਤੋਂ ਆ ਕੇ ਕਪੂਰਥਲੇ ਤੋਂ ਆਪਣਾ ਫਰਨੀਚਰ ਅਤੇ ਆਦਿ ਜਿਵੇਂ ਕਿ ਆਪਣਾ ਬੈੱਡ ਸੋਫੇ ਅਲਮਾਰੀਆਂ ਅਤੇ ਆਦਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੈ ਕੇ ਜਾਂਦੇ ਹਨ ਤੀਸ ਜੋ ਕਿ ਕਈ ਗੁਣਾ ਬਹੁਤ ਹੀ ਦੂਰ ਤੱਕ ਭੇਜਿਆ ਜਾਂਦਾ ਹੈ ਆਪਣਾ ਜਿਹੜਾ ਪੰਜਾਬ ਖੁਸ਼ਹਾਲ ਅਤੇ ਵਧੀਆ ਬਣਿਆ ਹੋਇਆ